ਪੁਰਾਤਨ ਸਮੇਂ ਵਿੱਚ ਖੂਹਾਂ ਵਿੱਚੋਂ ਪਾਣੀ ਬਲਦਾਂ ਨਾਲ਼ ਹਲਟੀ ਜੋੜ ਕੇ ਕੱਢਿਆ ਜਾਂਦਾ ਸੀ ਪਰ ਅੱਜ ਕੱਲ੍ਹ ਦੇ ਸਮੇਂ ਵਿੱਚ ਪਾਣੀ ਬਿਜਲੀ ਨਾਲ਼ ਚੱਲਣ ਵਾਲੀਆਂ ਮੋਟਰਾਂ ਦੁਆਰਾ ਕੱਢਿਆ ਜਾਂਦਾ ਹੈ